ਜੋ ਬਜਾਜ ਆਮਲਾ ਤੇਲ ਮੈਂ ਆਨਲਾਈਨ ਓਰਡਰ ਕੀਤਾ ਸੀ ਉਹ ਸ਼ੁਰੂਆਤ ਵਿੱਚ ਤਾਂ ਬਹੁਤ ਹੀ ਅੱਛਾ ਸੀਗਾ ਪਰ ਬਾਅਦ ਵਿੱਚ ਉਸ ਦਾ ਕਾਫੀ ਖਰਾਬ ਪ੍ਰਭਾਵ ਮੇਰੇ ਬਾਲਾਂ 'ਤੇ ਪਿਆ ਉ ਉਸ ਨਾਲ ਮੇਰੇ ਬਾਲਾਂ ਦੀ ਸੰਘਣਤਾ ਵੀ ਘੱਟ ਗਈ ਅਤੇ ਉਹ ਜਲਦੀ ਹੀ ਸਫੇਦ ਹੋਣ ਲੱਗ ਗਏ ਅਤੇ ਉਨ੍ਹਾਂ ਦਾ ਝੜਨਾ ਵੀ ਬਹੁਤ ਹੀ ਜ਼ਿਆਦਾ ਹੋ ਗਿਆ